ਵੈਸੇ ਤਾਂ ਆਪਾਂ ਗੱਲ ਕੀਤੀ ਜਾਵੇ ਕਿ ਆਪਣੇ ਪੰਜਾਬ ਦੇ ਵਿੱਚ ਆਪਾਂ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਵੈਸੇ ਮੈਂ ਪੰਜਾਬ ਤੋਂ ਬਿਲੌਂਗ ਕਰਦਾ ਹਾਂ ਆਪਾਂ ਗੱਲ ਕੀਤੀ ਜਾਵੇ ਆਪਣੇ ਪੰਜਾਬ ਤੋਂ ਮੈਂ ਸਿੱਖ ਧਰਮ ਤੋਂ ਬਿਲੌਗ ਕਰਦਾ ਹਾਂ ਆਪਣੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਜੋ ਸ਼ ਆਪਣੇ ਸ਼ਹੀਦ ਸ਼ਹੀਦਾਂ ਦੇ ਵਾਸਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਧਾਰਮਿਕ ਇੱਥੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਂਦ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਸ ਸੰਗਰਾਂਦ ਦਾ ਭੋਗ ਪਾਇਆ ਜਾਂਦਾ ਹੈ ਅਤੇ ਅਗਰ ਗੱਲ ਕੀਤੀ ਜਾਵੇ ਕਿਵੇਂ ਜਿਵੇਂ ਕਿ ਸੰਗਰਾਂਦ ਦੇ ਵਿੱਚ ਆਪਣੇ ਸ਼ਹੀਦਾਂ ਬਾਰੇ ਦੱਸਿਆ ਜਾਂਦਾ ਹੈ ਕੋਈ ਸ਼ਹੀਦੀ ਦਿਵਸ ਦੇ ਵਿਚ ਭੋਗ ਪਾਠ ਕਰਵਾਇਆ ਜਾਂਦਾ ਹੈ ਅਖੰਡ ਪਾਠ ਵੀ ਕਰਵਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਗਰ ਕੋਈ ਸ਼ਹੀਦ ਸ਼ਹੀਦ ਆਪਣਾ ਕੋਈ ਸ਼ਹੀਦ ਸ਼ ਹੋਇਆ ਹੈ ਜਿਸ ਦੇ ਬਾਰੇ ਮਤਲਬ ਕਿ ਆਪਾਂ ਗੱਲ ਕੀਤੀ ਜਾਵੇ ਸ਼ਹੀਦੀ ਇਹੋ ਜਿਹੀ ਚੀਜ਼ ਹੈ ਜਿ ਜਿਸ ਨੂੰ ਆਪਾਂ ਜਿੰਨਾਂ ਗੱਲ ਕਰੀਏ ਉਨੀਂ ਘੱਟ ਹੈ ਇਸ ਵਿੱਚ ਜਦੋਂ ਧਾਰਮਿਕ ਪ੍ਰੋਗਰਾਮ ਕੀਤੇ ਜਾਂਦੇ ਹਨ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਵਾਇਆ ਜਾਂਦਾ ਹੈ ਤਾਂ ਆਲ਼ੇ ਦੁਆਲ਼ੇ ਦੀ ਸੰਗਤ ਬਹੁਤ ਹੀ ਇਕੱਠੀ ਹੁੰਦੀ ਹੈ ਮੇਲੇ ਵੀ ਲਗਾਏ ਜਾਂਦੇ ਹਨ ਮੇਲਿਆਂ ਦੇ ਵਿੱਚ ਜਦੋਂ ਪ ਪ੍ਰੋਗਰਾਮ ਹੁੰਦਾ ਹੈ ਧਾਰਮਿਕ ਉਸ ਵਿੱਚ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਹੀਦਾਂ ਬਾਰੇ ਕਿ ਕਿਹਨੇ ਕਿੱਥੇ ਸ਼ਹੀਦੀ ਦਿੱਤੀ ਹੈ ਕਿਹਨੇ ਕਿੱਥੇ ਸ਼ਹੀਦੀ ਦਿੱਤੀ ਹੈ ਅਤੇ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਭੋਗ ਕਰਵਾਏ ਜਾਂਦੇ ਹਨ